ਹਾਂਜੀ ਮੇਰੀ ਕ੍ਰਿਸ਼ਨਾ ਜੀ ਨਾਲ ਗੱਲ ਹੋ ਰਹੀ ਹੈ ਹਾਂਜੀ ਮੈਂ ਨਾ ਉਹ ਆਰਤੀ ਗੱਲ ਕਰ ਰਹੀ ਸੀ ਉਹ ਨਾ ਆਂਟੀ ਜੀ ਮੈਂ ਤੁਹਾਡੇ ਨਾਲ ਗੱਲ ਕਰਨੀ ਸੀ ਕਿ ਨਾ ਅੱਜ ਕੱਲ੍ਹ ਮੈਨੂੰ ਨਾ ਸੂਬਹਾ ਤਾਂ ਟਾਈਮ ਨਹੀਂ ਮਿਲਿਆ ਗੱਲ ਕਰਨ ਦਾ ਅਤੇ ਨਾ ਹੁਣ ਮੈਂ ਫ੍ਰੀ ਹੋਈ ਸੀ ਫ੍ਰੀ ਹੋ ਦੋ ਮਿੰਟ ਗੱਲ ਹੋ ਜਾਏਗੀ ਕਿਉਂਕਿ ਸੂਬਹ ਮੇਰੇ ਤੋਂ ਫੇਰ ਫਿਰ ਨਹੀਂ ਗੱਲ ਹੋਣੀ ਤੁਹਾਡੇ ਨਾਲ ਉਹ ਨਾ ਮੈਂ ਨਾ ਥੋੜ੍ਹਾ ਜਿਹਾ ਤੁਹਾਨੂੰ ਨਾ ਖਾਣੇ ਬਾਰੇ ਕਹਿਣਾ ਸੀ ਅਤੇ ਨਾ ਵੀ ਜਿਹੜਾ ਤੁਸੀਂ ਸਵੇਰੇ ਮਤਲਬ ਮੇਰੇ ਨਾਲ ਜਿਹੜੀ ਦਾਲ ਭੇਜੀ ਸੀ ਨਾ ਉਹ ਨਾ ਬਹੁਤ ਜ਼ਿਆਦਾ ਪਤਲੀ ਸੀ ਅਤੇ ਸਟਾਫ ਦੇ ਸਾਹਮਣੇ ਤੁਹਾਨੂੰ ਪਤਾ ਹੈ ਨਾ ਫਿਰ ਐਵੇਂ ਖਾਣਾ ਤਾਂ ਥੋੜ੍ਹਾ ਜਿਹਾ ਹੈਂ ਉਹਦੇ ਬਾਰੇ ਠੀਕ ਕਰਨ ਬਾਰੇ ਅਤੇ ਨਾ ਜਿਹੜੀ ਦੁਪਹਿਰ ਵੇਲੇ ਸਬਜ਼ੀ ਬਣਾਈ ਹੋਈ ਸੀ ਸੁੱਕੀ ਅਤੇ ਉਹਦੇ 'ਚ ਤੇਲ ਬਹੁਤ ਜ਼ਿਆਦਾ ਸੀ ਹਾਂਜੀ ਤੁਹਾਨੂੰ ਪਤਾ ਹੈ ਨਾ ਇੰਨਾ ਹੈਵੀ ਖਾਣਾ ਠੀਕ ਨਹੀਂ ਰਹਿੰਦਾ ਉਹ ਵੀ ਇੰਨਾ ਜ਼ਿਆਦਾ ਓਈਲੀ ਤਾਂ ਫਿਰ ਹੈ ਨਾਂ ਤਾਂ ਕਰਕੇ ਅਤੇ ਉਹ ਨਾ ਸਰ ਵੀ ਸ਼ਿਕਾਇਤ ਕਰ ਰਹੇ ਸੀ ਜਿਹੜੇ ਤੁਸੀਂ ਚਾਵਲ ਭੇਜੇ ਸੀ ਨਾ ਉਹਨੇ ਨਾ ਉਹਨਾਂ ਨਾਲ ਟੀਫਨ 'ਚ ਉਹ ਵੀ ਨਾ ਕੱਚੇ ਹੈਗੇ ਸੀ ਉਹ ਨਾ ਥੋੜ੍ਹਾ ਸਵੇਰ ਖਾਣਾ ਬਣਾਉਂਦੇ ਟੈਮ ਨਾ ਥੋੜ੍ਹਾ ਧਿਆਨ ਰੱਖਿਆ ਕਰੋ ਥੋੜ੍ਹਾ ਨਾ ਦੇਖ ਲਿਆ ਕਰੋ ਪਹਿਲਾਂ ਕੱਢ ਕੇ ਉਹਨੂੰ ਵੀ ਚੈੱਕ ਕਰ ਲਿਆ ਕਰੋ ਖਾ ਕੇ ਕਿਉਂਕਿ ਤੁਹਾਨੂੰ ਪਤਾ ਫਿਰ ਉਹ ਸਟਾਫ ਮੈਂਬਰਸ ਅਤੇ ਸਾਹਮਣੇ ਟੀਫਨ ਵਗੈਰਾ ਖੋਲ੍ਹਦੇ ਹਾਂ ਉਹਨਾਂ ਨਾਲ ਸ਼ੇਅਰਿੰਗ ਹੁੰਦੀ ਹੈ ਤਾਂ ਥੋੜ੍ਹਾ ਕਿਵੇਂ ਲੱਗਦਾ ਨਾ ਅੱਛਾ ਅਤੇ ਨਾਲੇ ਤੁਸੀਂ ਸੂਬਹਾ ਬੱਚਿਆਂ ਨੇ ਕੀ ਮੰਗਿਆ ਸੀ ਹਾਂ ਤਾਂ ਹੀ ਉਹ ਬੋਲਦੇ ਪਏ ਸੀ ਕਹਿੰਦੇ ਨਾ ਵੀ ਮਮਾ ਸੂਬਹਾ ਆਮਲੇਟ ਦਾ ਕਿਹਾ ਸੀ ਅਤੇ ਆਂਟੀ ਜੀ ਨੇ ਨਾ ਪਰੌਂਠੀ ਬਣਾ ਕੇ ਦੇ ਦਿੱਤੀ ਸੀ ਗੁੱਸਾ ਕਰਦੇ ਪਏ ਸੀ ਉਹ ਅੱਛਾ ਅਤੇ ਨਾਲੇ ਨਾ ਉਹ ਤੁਸੀਂ ਜਿਹੜਾ ਕੱਲ੍ਹ ਸਾਗ ਬਣਾਇਆ ਸੀ ਉਹ ਨਾ ਵਧੀਆ ਤਰੀਕੇ ਨਾਲ ਨਾ ਰਿਨ੍ਹਿਆ ਨਹੀਂ ਹੋਇਆ ਮਤਲਬ ਵਧੀਆ ਤਰੀਕੇ ਨਾਲ ਘੋਟਿਆ ਨਹੀਂ ਹੋਇਆ ਉਹਨੂੰ ਹਾਂ ਉਹਨੂੰ ਨਾ ਹੁਣ ਵੀ ਪਿਆ ਹੈ ਅਤੇ ਉਹਨੂੰ ਨਾ ਮੈਂ ਤਾਂ ਸਵੇਰੇ ਜਲਦੀ 'ਚ ਨਿਕਲ ਜਾਉਗੀ ਅਤੇ ਪਿੱਛੋਂ ਫਿਰ ਉਹ ਮੰਮੀ ਉਹਨਾਂ ਨੇ ਖਾਣਾ ਹੁੰਦਾ ਅਤੇ ਉਹ ਕਹਿੰਦੇ ਪਏ ਸੀ ਕਹਿੰਦੇ ਨਾ ਵਧੀਆ ਘੋਟਿਆਂ ਨਹੀਂ ਹੋਇਆ ਸੀ ਹਾਂ ਥੋੜ੍ਹਾ ਨਾ ਹੁਣ ਤੁਹਾਨੂੰ ਵਧੀਆ ਤਰੀਕੇ ਨਾਲ ਘੋਟ ਕੇ ਅਤੇ ਨਾ ਵਧੀਆ ਤੜਕਾ ਲਾ ਦਿਓ ਜੀ ਤੁਹਾਨੂੰ ਪਤਾ ਮੰਮੀ ਫਿਰ ਪੁਰਾਣੇ ਖਿਆਲਾਂ ਦੇ ਹੈਗੇ ਐ ਅਤੇ ਉਹਨਾਂ ਨੂੰ ਆਪਦੇ ਹੱਥਾਂ ਨਾਲ ਹੀ ਘੋਟਿਆ ਜ਼ਿਆਦਾ ਪਸੰਦ ਆਉਂਦਾ ਤੁਸੀਂ ਥੋੜ੍ਹਾ ਜਿਹਾ ਦੇਖ ਲਿਓ ਜੀ ਹੈਂ ਅਤੇ ਹਾਂਜੀ ਅਤੇ ਹੋਰ ਹਾਂ ਹੋਰ ਸਭ ਕੁਛ ਠੀਕ ਹੈ ਬਾਕੀ ਤੁਸੀਂ ਥੋੜ੍ਹਾ ਨਾ ਖਾਣਾ ਬਣਾਉਂਦੇ ਟੈਮ ਥੋੜ੍ਹਾ ਜਿਹਾ ਧਿਆਨ ਰੱਖਿਆ ਕਰੋ ਵੀ ਥੋੜ੍ਹਾ ਨਾ ਹਾਂ ਵੀ ਮਤਲਬ ਭੇਜ ਪੈਕ ਕਰਨ ਤੋਂ ਪਹਿਲਾਂ ਨਾ ਚੈੱਕ ਕਰ ਲਿਆ ਕਰੋ ਇੱਕ ਵਾਰੀ ਹਾਂਜੀ ਓਕੇ ਜੀ